ਹਾਂਜੀ ਮੈਂ ਬੁਲਾਈ ਬੁਣਾਈ ਦਾ ਕੰਮ ਅਤੇ ਸਿਲਾਈ ਦਾ ਕੰਮ ਕਰ ਲੈਂਦੀ ਹਾਂ ਮੈਂ ਕਰੋਸ਼ੀਆ ਦਾ ਵੀ ਕੰਮ ਕਰ ਲੈਂਦੀ ਹਾਂ ਪਰ ਫਿਰ ਵੀ ਇਹ ਚੀਜ਼ਾਂ ਵਿੱਚ ਇੰਨੀ ਕੁ ਅੱਜ ਕੱਲ੍ਹ ਤਰੱਕੀ ਹੋਈ ਹੋਈ ਹੈ ਕਿ ਅਸੀਂ ਫਿਰ ਵੀ ਸਾਨੂੰ ਕੁਛ ਨਾ ਕੁਛ ਸਿੱਖਣ 'ਚ ਆ ਜਾਂਦਾ ਹੈ ਜਿਸ ਤਰ੍ਹਾਂ ਮੈਂ ਸਿਲਾਈ ਦਾ ਬੜੇ ਅੱਛੇ ਸਵੈਟਰ ਸ਼ਾਲ ਬਣਾ ਲੈਂਦੀ ਹਾਂ ਨੀਟਿੰਗ ਦੇ ਵਿੱਚ ਔਰ ਕਰੋਸ਼ੀਆ ਦੇ ਵਿੱਚ ਵੀ ਮੈਂ ਭਗਵਾਨ ਜੀ ਦੇ ਕੱਪੜੇ ਬੱਚਿਆਂ ਦੇ ਪੌਚੂ ਸਵੈਟਰ ਸ਼ਾਲਾਂ ਸੋਕਸ ਵਗੈਰਾ ਬੜਾ ਕੁਛ ਬਣਾ ਲੈਂਦੀ ਹਾਂ ਪਰ ਫੇਰ ਵੀ ਕਈ ਅਸੀਂ ਗੂਗਲ 'ਚ ਸਰਚ ਕਰੀਏ ਯੂਟਿਊਬ 'ਚ ਸਰਚ ਕਰੀਏ ਜਾਂ ਔਨਲਾਈਨ ਕੁਛ ਦੇਖੀਏ ਕਈ ਚੀਜ਼ਾਂ ਇਹ ਫੇਰ ਵੀ ਉਹੋ ਜਿਹੀਆਂ ਜਿਹੜੀਆਂ ਅਸੀਂ ਆਪਣੇ ਹੱਥੋਂ ਨਹੀਂ ਕੱਢੀਆਂ ਅਤੇ ਸਾਨੂੰ ਕੱਢਣੀਆਂ ਚਾਹੀਦੀਆਂ ਹੈ ਕਿਉਂਕਿ ਇਹ ਜ਼ਿੰਦਗੀ ਵਿੱਚ ਉਮਰ ਵਿੱਚ ਕੁਛ ਨਾ ਕੁਛ ਇਨਸਾਨ ਨੂੰ ਸਿੱਖਣ 'ਚ ਜ਼ਰੂਰ ਮਿਲਦਾ ਹੈ ਕੋਈ ਵੀ ਇਨਸਾਨ ਇੰਨਾ ਕੁ ਨਿਪੁੰਨ ਨਹੀਂ ਹੁੰਦਾ ਕਿ ਉਹ ਆਪਣੀ ਹਰ ਚੀਜ਼ 'ਚ ਮਾਹਰ ਹੋਵੇ ਉਹਨੂੰ ਫਿਰ ਵੀ ਕੋਈ ਨਾ ਕੋਈ ਨਵੀਂ ਚੀਜ਼ ਸਾਹਮਣੇ ਆ ਹੀ ਜਾਂਦੀ ਆ ਸਿੱਖਣ ਵਾਸਤੇ ਹੁਣ ਇਹ ਸ਼ਟਰਿੰਗ ਲੈ ਲਓ ਮੈਨੂੰ ਨਹੀਂ ਆਉਂਦੀ ਮੈਂ ਸਿੱਖਣਾ ਚਾਹੁੰਦੀ ਹਾਂ ਪਰ ਕੋਈ ਯੂਟਿਊਬ ਦੇ ਸਹਾਰੇ ਜਾਂ ਮੈਂ ਗੂਗਲ ਦੇ ਸਹਾਰੇ ਕੁਛ ਸਿੱਖੀ ਵੀ ਹੈ ਸਿੰਗਲ ਸ਼ਟਲ ਮੈਂ ਚਲਾ ਹੀ ਲੈਂਦੀ ਹਾਂ ਲੇਕਿਨ ਡਬਲ ਸਟਿਚਿੰਗ ਨਹੀਂ ਮੈਨੂੰ ਆਉਂਦੀ ਸ਼ਟਲ 'ਚ ਉਹ ਮੈਂ ਸਿੱਖਣਾ ਚਾਹੁੰਦੀ ਹਾਂ ਉਹ ਮੈਂ ਹੁਣ ਨੈਟ 'ਚੋਂ ਸਰਚ ਕਰ ਰਹੀ ਹਾਂ ਕਿ ਮੈਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਜਿਵੇਂ ਕਰੋਸ਼ੀਏ ਵਿੱਚ ਹੀ ਲੈ ਲਉ ਅੱਜ ਕੱਲ੍ਹ ਲੋਕ ਕਰੋਸ਼ੀਆ ਦੇ ਬਹੁਤ ਜ਼ਿਆਦਾ ਸੋਹਣੇ ਟੋਆਏਜ਼ ਬਣਾਉਂਦੇ ਨੇ ਖਿਡੌਣੇ ਬਣਾਉਂਦੇ ਨੇ ਔਰ ਫੋਰਨ ਦੇ ਕੰਟਰੀ 'ਚ ਵੀ ਇਹ ਕਰੋਸ਼ੀਆ ਬਹੁਤ ਚੱਲ ਰਿਹਾ ਹੈ ਜਿੱਥੋਂ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲ ਰਿਹਾ ਕਈ ਚੀਜ਼ਾਂ ਨਹੀਂ ਸਾਨੂੰ ਪਤਾ ਸੀ ਸਾਡੀ ਜਾਣਕਾਰੀ 'ਚ ਨਹੀਂ ਸੀ ਜੋ ਕਿ ਅਸੀਂ ਸਿੱਖੀਆਂ ਹੈ ਯੂਟਿਊਬ ਤੋਂ ਇੰਟਰਨੈਟ ਤੋਂ ਸਰਚ ਮਾਰੀ ਆ ਯੂਟਿਊਬ ਤੋਂ ਗੂਗਲ 'ਚ ਅਸੀਂ ਬਹੁਤ ਕੁਛ ਸਿੱਖਿਆ ਹੈ ਔਰ ਸਿੱਖਣਾ ਚਾਹੁੰਦੇ ਹਾਂ